ਮੈਂ ਭਜਨ ਸਿੰਘ ਬੋਲ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਅ ਚਾਰ ਟਿਕਟਾਂ ਬੁੱਕ ਕਰਵਾਈਆਂ ਸਨ ਇੱਕ ਟਿਕਟ ਦਾ ਤਿੰਨ ਸੌ ਰੁਪਿਆ ਲੱਗਿਆ ਸੀ ਚਾਰ ਟਿਕਟਾਂ ਦੇ ਬਾਰਾਂ ਸੌ ਰੁਪਏ ਦਿੱਤੇ ਸਨ ਕਸਟਮਰ ਆਈਡੀ ਦੋ ਚਾਰ ਛੇ ਅੱਠ ਸੱਤ ਜੀਰੋ ਤਿੰਨ ਨੌਂ ਇਸ ਨੰਬਰ 'ਤੇ ਬੁੱਕ ਕਰਵਾਏ ਸੀ ਅਤੇ ਸਾਡੇ ਵਿੱਚੋਂ ਇੱਕ ਬੰਦਾ ਜੋ ਕਿ ਕਿਸੇ ਹਾਲਤ ਦੇ ਵਿੱਚ ਜਾ ਨਹੀਂ ਸਕਦਾ ਇਸ ਕਰਕੇ ਮੈਂ ਉਸ ਕਸਟਮਰ ਦਾ ਆਈਡੀ ਇੱਕ ਸੱਤ ਛੇ ਪੰਜ ਚਾਰ ਨੌਂ ਚਾਰ ਤਿੰਨ ਜੀਰੋ 'ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ ਕਿ ਮੇਰਾ ਜਿਹੜਾ ਦੇਣ ਦਾ ਵੈਹੈ ਕਸਟ ਮ ਟਿਕਟ ਵ ਵਾਪਸ ਕਰਨ ਦਾ ਵਿਚਾਰ ਹੈ ਇਸ ਕਰਕੇ ਕੀ ਮੈਨੂੰ ਪਤਾ ਲੱਗ ਸਕਦਾ ਹੈ ਕਿ ਤੇ ਤਿੰਨ ਬੰਦਿਆਂ ਦੀ ਟਿਕਟਾਂ ਤਾਂ ਠੀਕ ਨੇ ਜਿਹੜਾ ਇੱਕ ਬੰਦਾ ਨਹੀਂ ਜਾ ਸਕਦਾ ਉਸ ਦੇ ਤਿੰਨ ਸੌ ਰੁਪਏ ਵਾਪਸ ਹੋਣੇ ਚਾਹੀਦੇ ਹਨ ਕੀ ਮੈਨੂੰ ਇਸ ਬਾਰੇ ਪਤਾ ਕਰ ਦਿੱਤਾ ਜਾਵੇਗਾ ਕਿ ਤੁਹਾਡਾ ਜੋ ਵੀ ਮੈਂ ਇਸ ਰਿਕਾਰਡ ਬਾਰੇ ਰਿਟਨ ਵਿੱਚ ਦਿੱਤਾ ਹੈ ਉਹ ਠੀਕ ਹੋ ਗਿਆ ਕਿ ਨਹੀਂ ਇਸ ਬਾਰੇ ਜਾਣਕਾਰੀ ਮਿਲੀ ਜਾਵੇ ਕਿ ਮੇਰੀ ਇਹ ਦੂਜੇ ਤੀਜੇ ਇੱਕ ਬੰਦੇ ਦੀ ਘਾਟ ਇਹ ਤਿੰਨ ਸੌ ਰੁਪਏ ਦੀ ਵਾਪਸੀ ਬਾਰੇ ਮੈਨੂੰ ਸਾਰੀ ਜਾਣਕਾਰੀ ਦਿਓ ਵੀ ਹਾਂ ਮੇਰਾ ਕੰਮ ਜੋ ਵੀ ਮੈਂ ਲਿਖ ਕੇ ਦਿੱਤਾ ਹੈ ਜੋ ਵੀ ਟਿਕਟ ਵਾਪਸ ਕਰਨੀ ਹੈ ਉਸ ਬਾਰੇ ਮੈਨੂੰ ਵੀ ਦੱਸਿਆ ਜਾਵੇ ਵੀ ਮੇਰੀ ਇਹ ਗੱਲ ਸੈੱਟ ਹੋ ਗਈ ਹੈ ਤਾਂ ਕਿ ਮੈਨੂੰ ਆਉਣ ਬਾਰੇ ਜਾਂ ਜਾਣ ਬਾਰੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਰੇਲਵੇ ਮਹਿਕਮੇ ਬਾਰੇ ਸਾਰੀ ਗੱਲ ਦੱਸੀ ਜਾਵੇ